ਸਾਡੇ ਇਲਾਕੇ ਵਿੱਚ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਸੁਵਿਧਾਵਾਂ ਉਪਲਬਧ ਹਨ ਜਿਵੇਂ ਕਿ ਇੱਥੇ ਬਹੁਤ ਸਾਰੀਆਂ ਬੱਸਾਂ ਚੱਲਦੀਆਂ ਹਨ ਅਲੱਗ ਅਲੱਗ ਖੇਤਰਾਂ ਲਈ ਅਲੱਗ ਅਲੱਗ ਟਾਇਮ 'ਤੇ ਬੱਸਾਂ ਚੱਲਦੀਆਂ ਹੈਗੀਆਂ ਹੈ ਇੱਥੇ ਰੇਲਾਂ ਦੀ ਸੁਵਿਧਾ ਵੀ ਉਪਲਬਧ ਹੈਗੀ ਹੈ ਅਤੇ ਟਰਾਂਸਪੋਰਟ ਦਾ ਤਾਂ ਬਹੁਤ ਹੀ ਵਧੀਆ ਇੱਥੇ ਉਹ ਪ੍ਰਬੰਧ ਹੈਗਾ ਹੈ ਇੱਥੇ ਜਦੋਂ ਰੇਲਾਂ ਵਿੱਚ ਬੰਦੇ ਜਾਂਦੇ ਹੈਗੇ ਅਤੇ ਰੇਲਾਂ ਵਿੱਚ ਖਾਣ ਪੀਣ ਦਾ ਤਰ੍ਹਾਂ ਤਰ੍ਹਾਂ ਦਾ ਸਮਾਨ ਮਿਲਦਾ ਬੱਸ ਸਟੈਂਡ ਵੀ ਬੜੇ ਵਧੀਆ ਬਣਾਏ ਹੈਗੇ ਹੈ ਅਤੇ ਪੂਰੀ ਤਰ੍ਹਾਂ ਡਿਵੇਲਪ ਹੈਗੇ ਹੈ ਬੱਸ ਸਟੈਂਡ ਵਿੱਚ ਢਾਬੇ ਅਤੇ ਖਾਣ ਪੀਣ ਲਈ ਸਵਾਰੀਆਂ ਉੱਥੇ ਆਉਂਦੀਆਂ ਹੈਗੀਆਂ ਹੈ ਅਤੇ ਬੜਾ ਵਧੀਆ ਉੱਥੇ ਉਹਦਾ ਬੜਾ ਵਧੀਆ ਦ੍ਰਿਸ਼ ਬਣਦਾ ਹੈਗਾ ਅਤੇ ਰਹਿਣ ਸਹਿਣ ਲਈ ਉੱਥੇ ਵੀ ਵਧੀ ਬੜਾ ਵਧੀਆ ਹੈ ਉਹ ਉਨ੍ਹਾਂ ਨੇ ਕਮਰੇ ਵਗੈਰਾ ਤਿਆਰ ਕੀਤੇ ਹੈਗੇ ਅਤੇ ਹੋਟਲਸ ਵੀ ਬੜੇ ਵਧੀਆ ਹੈਗੇ ਇਸ ਤਰ੍ਹਾਂ ਆਪਾਂ ਦੇਖ ਸਕਦੇ ਕਿ ਜਿਹੜਾ ਸਾਡਾ ਇਲਾਕਾ ਰੋਪੜ ਹੈਗਾ ਹੈ ਇਹ ਬਰੀ ਤਰ੍ਹਾਂ ਪੂਰੀ ਤਰ੍ਹਾਂ ਵੈਲ ਔਰਗਨਾਇਜ਼ਡ ਅਤੇ ਵੈਲ ਡਿਪੈਲਪ ਹੈਗਾ ਹੈ